ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ

ਠੀ ਠੀਕ ਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੀ ਸਾਡੇ ਨਰਸਰੀ 'ਚ ਇੰਟਰਸਟ ਦਿਖਾਉਣ ਲਈ ਅਤੇ ਸਾਡੇ ਕੋਲੇ ਬਹੁਤ ਜ਼ਿਆਦਾ ਇਨਡੋਰ ਪਲਾਂਟਸ ਹੈਗੇ ਆ ਅੱਡ ਅੱਡ ਤਰ੍ਹਾਂ ਦੇ ਪਲਾਂਟਸ ਆ ਪਰ ਡਿਪੈਂਡ ਕਰਦਾ ਵੀ ਕਸਟਮਰ ਨੂੰ ਕਿੱਦਾਂ ਦੇ ਪਲਾਂਟਸ ਚਾਹੀਦੇ ਆ ਇਨਵਾਇਰਮੈਂਟ ਦੇ ਹਿਸਾਬ ਨਾਲ ਕਈਆਂ ਦੇ ਘਰਾਂ 'ਚ ਲਾਈਟ ਹੁੰਦੀ ਆ ਨਹੀਂ ਹੁੰਦੀ ਅਤੇ ਮੈਂ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਪਲਾਂਟਸ ਦੱਸਦੀ ਹਾਂ ਠੀਕ ਠੀਕ ਹੈ ਜੀ ਠੀਕ ਹੈ ਆਪਣੇ ਕੋਲ ਇੱਦਾਂ ਦੇ ਆ ਵੀ ਜਿਵੇਂ ਕਈ ਵਾਰ ਤੁਹਾਡਾ ਟਾਈਮ ਨਹੀਂ ਲੱਗਦਾ ਮੈਂਟੇਨੈਂਸ ਨਹੀਂ ਕਰਨੀ ਪੈਣੀ ਤੁਹਾਨੂੰ ਇੱਦਾਂ ਲੋ ਮੈਂਟੇਨਸ ਵਾਲੇ ਪਲਾਂਟਸ ਆ ਜਿਵੇਂ ਕਿ ਸਨੇਕ ਪਲਾਂਟ ਆ ਵੀਜੀ ਪਲਾਂਟ ਆ ਸਪਾਈਡਰ ਪਲਾਂਟ ਆ ਪੋਥੋਜ ਆ ਜਿਹਨੂੰ ਮਨੀ ਪਲਾਂਟ ਕਹਿ ਦਿੰਦੇ ਆ ਇਹਨਾਂ ਨੂੰ ਭਲਾ ਮਹੀਨੇ ਬਾਅਦ ਤੁਸੀਂ ਖਾਦ ਪਾ ਸਕਦੇ ਹੋ ਮਹੀਨੇ ਬਾਅਦ ਹੀ ਜਿਵੇਂ ਪੰਦਰ੍ਹਾਂ ਵੀਹ ਦਿਨਾਂ ਵੱਧ ਪਾਣੀ ਪਾ ਸਕਦੇ ਹੋ ਅਤੇ ਜ਼ਿਆਦਾ ਪਾਣੀ ਪਾਵਾਂਗੇ ਤਾਂ ਇਹਨਾਂ ਦੀਆਂ ਜੜਾਂ ਖਰਾਬ ਹੋ ਸਕਦੀਆਂ ਤਾਂ ਕਰਕੇ ਤੁਹਾਨੂੰ ਪਾਣੀ ਦਾ ਵੀ ਧਿਆਨ ਰੱਖਣਾ ਪੈਣਾ ਇਹ ਪੌਦਿਆਂ 'ਚ ਤਾਂ ਹੀ ਕਰਕੇ ਇਹਨਾਂ ਨੂੰ ਲੋ ਮੈਂਟੇਨੈਂਸ ਕਿਹਾ ਜਾਂਦਾ ਹੈ ਅਤੇ ਜੇ ਤੁਹਾਡੇ ਘਰੇ ਕਮਰਿਆਂ ਦੇ ਵਿੱਚ ਜੇ ਤੁਹਾਡੇ ਘੱਟ ਲਾਈਟ ਹੈਗੀ ਮਤਲਬ ਥੋੜ੍ਹੀ ਬਹੁਤ ਲਾਈਟ ਆਉਂਦੀ ਆ ਅਤੇ ਉਹਦੇ ਵਿੱਚ ਤੁਸੀਂ ਪੀਸ ਲੀਲੀ ਰੱਖ ਸਕਦੇ ਹੋ ਸਲੇਕ ਪਲਾਂਟ ਵੀ ਰੱਖ ਸਕਦੇ ਹੋ ਅਤੇ ਚਾਈਨੀਜ਼ ਐਵਰਗਰੀਨ ਵੀ ਰੱਖ ਸਕਦੇ ਹੋ ਜਿਹੜਾ ਪੀਸ ਲਿਲੀ ਪਲਾਂਟ ਆ ਉਹਦੇ ਵਿੱਚ ਵਾਈਟ ਕਲਰ ਦੀ ਪੱਤੀ ਜੀ ਨਿਕਲੀ ਹੁੰਦੀ ਆ ਇਹ ਪੁੱਲ ਵਰਗੀ ਹੁੰਦੀ ਆ ਪੋਲੀ ਹੁੰਦੇ ਆ ਪੀਸ ਲੀਲੀ ਦੇ ਇੱਕ ਰੈਡ ਕਲਰ ਦੇ ਹੁੰਦੇ ਆ ਇਹਨਾਂ ਦੀ ਟਾਈਪ ਡਿਫਰੈਂਟ ਡਿਫਰੈਂਟ ਆ ਇਹ ਜਿਹੜੇ ਚਾਈਨੀਜ਼ ਐਵਰਗਰੀਨ ਆ ਇਹ ਵੀ ਸਿਰਫ ਗ੍ਰੀਨਰੀ ਲਈ ਹੁੰਦਾ ਇਹਦੇ ਵਿੱਚ ਪੱਤੇ ਹੀ ਪੱਤੇ ਹੁੰਦੇ ਆ ਇੱਕ ਜੇ ਤੁਸੀਂ ਆਪਦੇ ਘਰ ਦੀ ਪ੍ਰਦੂਸ਼ਣ ਵਧੀਆ ਕਰਨੀ ਆ ਅਤੇ ਉਹਦੇ ਲਈ ਦੋ ਪਲਾਂਟਸ ਹੈਗੇ ਇੱਕ ਰਬਰ ਪਲਾਂਟ ਆ ਇੱਕ ਬਾਮੂ ਪਾਮ ਆ ਇਹ ਸਾਰੇ ਪਲਾਂਟ ਤੁਸੀਂ ਹਾਂਜੀ ਜਿਵੇਂ ਹੁਣ ਤੁਸੀਂ ਜਿਵੇਂ ਤੁਸੀਂ ਹੁਣ ਕੋਈ ਅਗਰ ਤੁਹਾਡੇ ਘਰੇ ਪਲਾਂਟਸ ਨਹੀਂ ਤੁਸੀਂ ਪਹਿਲੀ ਵਾਰ ਰੱਖਣ ਲੱਗਾ ਤਾਂ ਤੁਹਾਨੂੰ ਨੇਕ ਪਲਾਂਟ ਮਨੀ ਪਲਾਂਟ ਜਾਂ ਫਿਰ ਸਪਾਈਡਰ ਪਲਾਂਟ ਅਤੇ ਚਾਇਨੀਜ਼ ਐਵਰਗਰੀਨ ਇੱਦਾਂ ਦੇ ਪੌਦੇ ਤੁਹਾਡੇ ਘਰੇ ਸੂਟ ਹੋਣ ਹੋਣਗੇ ਇੰਡੋਰ ਪਲਾਂਟਸ ਕਿਉਂਕਿ ਇਹਨਾਂ ਨੂੰ ਪਾਣੀ ਵੀ ਬਹੁਤ ਘੱਟ ਲੱਗਦਾ ਹੈ ਅਤੇ ਨਾਲੇ ਇਹਨੂੰ ਖਾਦ ਵੀ ਹਾਂਜੀ ਹਾਂਜੀ ਖਾਦ ਵੀ ਤੁਹਾਨੂੰ ਮਹੀਨੇ ਬਾਅਦ ਹੀ ਪਾਉਣੀ ਪਵੇਗੀ ਜਿਵੇਂ ਅੱਡ ਅੱਡ ਤਰ੍ਹਾਂ ਦੀਆਂ ਖਾਦ ਹੁੰਦੀਆਂ ਆਪਾਂ ਘਰੋਂ ਵੀ ਖਾਦ ਬਣਾ ਸਕਦੇ ਹਾਂ ਨੈਚੁਰਲ ਤਰੀਕੇ ਨਾਲ ਜਿਵੇਂ ਕਿ ਡੀਏਪੀ ਹੋ ਗਈ ਗੋਬਰ ਦੀ ਖਾਦ ਹੋ ਗਈ ਅਤੇ ਜਿਵੇਂ ਆਪਣੇ ਪਿਆਜ ਦੇ ਛਿੱਲੜ ਹੁੰਦੇ ਉਹਨਾਂ ਨੂੰ ਵੀ ਭਿਉਂ ਕੇ ਤੁਸੀਂ ਰੱਖ ਸਕਦੇ ਹੋ ਅਤੇ ਉਹਨਾਂ ਦਾ ਪਾਣੀ ਇੱਕ ਲੀਟਰ ਦੋ ਲੀਟਰ ਪਾਣੀ ਜਿੰਨੇ ਕੁ ਪੌਦੇ ਉਸ ਹਿਸਾਬ ਨਾਲ ਪਾ ਕੇ ਅਤੇ ਤੁਸੀਂ ਆਪਦੇ ਪੌਦਿਆਂ ਨੂੰ ਦੇ ਸਕਦੇ ਹੋ ਹਾਂਜੀ ਜਿਹਦੇ ਹਾਂਜੀ ਹਾਂਜੀ ਜੇ ਤੁਸੀਂ ਪਹਿਲੀ ਵਾਰ ਤੁਸੀਂ ਸਾਡੇ ਤੋਂ ਪਹਿਲੀ ਵਾਰ ਲੈ ਰਹੇ ਹੋ ਅਤੇ ਤੁਹਾਨੂੰ ਅਸੀਂ ਪੰਦਰ੍ਹਾਂ ਤੋਂ ਵੀਹ ਪ੍ਰਸੈਂਟ ਡਿਸਕਾਊਂਟ ਦੇਵਾਂਗੇ ਅਤੇ ਤੁਸੀਂ ਦੂਜੀ ਵਾਰ ਆਓਂਗੇ ਤਾਂ ਤੁਹਾਨੂੰ ਪੰਜ ਪ੍ਰਸੈਂਟ ਦਾ ਡਿਸਕਾਊਂਟ ਮਿਲੇਗਾ ਅਤੇ ਨਾਲੇ ਇੱਕ ਕੋਈ ਫਲਾਵਰਿੰਗ ਵਾਲਾ ਪਲਾਂਟ ਤੁਹਾਨੂੰ ਫ੍ਰੀ ਦਿੱਤਾ ਜਾਵੇਗਾ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਗੂਗਲ ਪੇ ਕਰ ਦਿਓ ਠੀਕ ਆ ਜੀ ਠੀਕ ਆ ਠੀਕ ਹੈ ਜੀ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ